ਮੈਨੂੰ ਟੀ ਵੀ ਦੇ ਪ੍ਰੋਗਰਾਮ ਵਿੱਚ ਰਾਮਲੀਲਾ ਦਾ ਪ੍ਰੋਗਰਾਮ ਵਧੀਆ ਲੱਗਾ ਰਾਮਲੀਲਾ ਦਾ ਪ੍ਰੋਗਰਾਮ ਟੀ ਵੀ ਵਿੱਚ ਨੌ ਵਜੇ ਸ਼ੁਰੂ ਹੁੰਦਾ ਸੀ ਰਾਮਲੀਲਾ ਦੇ ਪਹਿਲੇ ਦਿਨ ਸ਼ਰਵਣ ਕੁਮਾਰ ਅਤੇ ਰਾਮ ਜਨਮ ਦਾ ਦ੍ਰਿਸ਼ ਵਿਖਾਇਆ ਗਿਆ ਜੋ ਕਿ ਬਹੁਤ ਹੀ ਚੰਗਾ ਲੱਗਾ ਰਾਮਲੀਲਾ ਦੇ ਦੂਜੇ ਦਿਨ ਲਛਮਣ ਭਰਤ ਸ਼ਤਰੂਗਨ ਦੇ ਬਾਲ ਰੂਪ ਅਤੇ ਅਯੋਧਿਆ ਦੇ ਮਨੋਹਰ ਦ੍ਰਿਸ਼ ਦਿਖਾਏ ਗਏ ਰਾਮਲੀਲਾ ਦੇ ਤੀਸਰੇ ਦਿਨ ਰਾਮ ਲਛਮਣ ਭਰਤ ਸ਼ਤਰੂਗਨ ਦੀ ਪੜ੍ਹਾਈ ਦੇ ਦ੍ਰਿਸ਼ ਦਿਖਾਏ ਗਏ ਚੌਥੀ ਰਾਤ ਸੀਤਾ ਸਵੰਬਰ ਅਤੇ ਲਛਮਣ ਪਰਸ਼ੂਰਾਮ ਦੇ ਸੰਵਾਦ ਹੋਈ ਪੰਜਵੀਂ ਰਾਜ ਰਾਮ ਬਨਵਾਸ ਅਤੇ ਭਰਤ ਰਾਮ ਮਿਲਾਪ ਨੂੰ ਵਿਖਾਇਆ ਗਿਆ ਭਰਤ ਅਤੇ ਰਾਮ ਦਾ ਮਿਲਾਪ ਦਿਲ ਨੂੰ ਛੂਹ ਜਾਣ ਵਾਲਾ ਸੀ ਛੇਵੀਂ ਰਾਤ ਸੀਤਾ ਹਰਨ ਰਾਮ ਦਾ ਹਨੂੰਮਾਨ ਜੀ ਦਾ ਮਿਲਣ ਵਿਖਾਇਆ ਗਿਆ ਸੱਤਵੀਂ ਰਾਤ ਬਾਲੀ ਦਾ ਸੰਘਾਰ ਲੰਕਾ ਨੂੰ ਸਾੜਨਾ ਦਾ ਦ੍ਰਿਸ਼ ਲੰਕਾ ਨੂੰ ਸਾੜਨ ਦਾ ਦ੍ਰਿਸ਼ ਦਿਖਾਇਆ ਗਿਆ ਅੱਠਵੀਂ ਰਾਤ ਲਛਮਣ ਮੂਰਛਾ ਅਤੇ ਰਾਮ ਨੂੰ ਇੱਕ ਸਾਮਾਨ ਆਦਮੀ ਦੇ ਰੂਪ ਵਿੱਚ ਵਿਲਾਪ ਕਰਦਾ ਹੋਇਆ ਦਿਖਾਇਆ ਗਿਆ ਫੇਰ ਰਾਮਲੀਲਾ ਦੇ ਅੰਤਿਮ ਦਿਨ ਰਾਮ ਰਾਵਣ ਦਾ ਯੁੱਧ ਦਿਖਾਇਆ ਗਿਆ ਅਤੇ ਇਹ ਘੋਸ਼ਣਾ ਕੀਤੀ ਗਈ ਕਿ ਰਾਮ ਦਾ ਰਾਵਣ ਦੇ ਨਾਲ਼ ਯੁੱਧ ਹੋਇਆ ਅਤੇ ਉਸ ਵਿੱਚ ਰਾਵਣ ਨੂੰ ਮਰਿਆ ਹੋਇਆ ਦਿਖਾਇਆ ਗਿਆ ਰਾਮਲੀਲਾ ਦੇ ਇਹ ਅੱਠ ਦਿਨ ਖੁਸ਼ੀ ਖੁਸ਼ੀ ਪੜ੍ਹੇ ਦਿਖਾਏ ਗਏ ਰਾਮਲੀਲਾ ਦਾ ਮਨੁੱਸ਼ਯ ਜੀਵਨ ਦੇ ਵਿੱਚ ਬਹੁਤ ਵੱਡਾ ਰੋਲ ਹੈ